ਹੈਲੋ ਬਸ ਠੀਕ ਆ ਤੁਸੀਂ ਸੁਣਾਓ ਕੀ ਹਾਲ ਹੈ ਤੁਹਾਡਾ ਬਹੁਤ ਚੰਗਾ ਬੱਚੇ ਸਕੂਲ ਗਏ ਹੋਏ ਨੇ ਅੱਛਾ ਅੱਛਾ ਹਾਂਜੀ ਅੱਛਾ ਹਾਂਜੀ ਹਾਂਜੀ ਮੇਰੇ ਮੇਰੇ ਬੱਚੇ ਪੜ੍ਹਦੇ ਨੇ ਡੀ ਏ ਵੀ ਪਬਲਿਕ ਸਕੂਲ ਦੇ ਵਿੱਚ ਸਕੂਲ ਤਾਂ ਬਹੁਤ ਵਧੀਆ ਹੈ ਸ਼ੁਰੂ ਤੋਂ ਹੀ ਉਹ ਪੜ੍ਹਦੇ ਆ ਰਹੇ ਹੈ ਅਤੇ ਸਕੂਲ ਤਾਂ ਬਹੁਤ ਵਧੀਆ ਤੁਸੀਂ ਦੇਖ ਲਉ ਨਹੀਂ ਮੇਰੇ ਕੋਲ ਹੋਰ ਵੀ ਕਈ ਸਕੂਲਾਂ ਦੇ ਮੈਂ ਪੜ੍ਹਾਉਂਦੀ ਹਾਂ ਤਾਂ ਮੇਰੇ ਕੋਲ ਹੋਰ ਵੀ ਕਈ ਸਕੂਲਾਂ ਦੇ ਬੱਚੇ ਆਉਂਦੇ ਆ ਜਿੱਦਾਂ ਸਕੂਲ ਹੋ ਗਿਆ ਦੂਨ ਸਕੂਲ ਹੋ ਗਿਆ ਮਾਊਂਟ ਲੈਟਰਾ ਸਕੂਲ ਹੋ ਗਿਆ ਸਕੂਲ ਤਾਂ ਬਹੁਤ ਸਾਰੇ ਹੈਗੇ ਹੈ ਪਰ ਇਹਨਾਂ ਵਿੱਚੋਂ ਮੈਨੂੰ ਜਿੱਥੋਂ ਤੱਕ ਲੱਗਿਆ ਕਿ ਡੀ ਏ ਵੀ ਸੀ ਬੀ ਐੱਸ ਈ ਸਕੂਲ ਵੀ ਹੈਗਾ ਪੜ੍ਹਾਈ ਵੀ ਚੰਗੀ ਹੈਗੀ ਹੈ ਜੇ ਤੁਸੀਂ ਉੱਥੇ ਪਾਉਣਾ ਚਾਹੁੰਦੇ ਹੋ ਤਾਂ ਉੱਥੇ ਬਹੁਤ ਵਧੀਆ ਸਕੂਲ ਹੈ ਸਕੂਲ ਤਾਂ ਹੋਰ ਵੀ ਹੈ ਪਰ ਫੀਸਾਂ ਬਹੁਤ ਜ਼ਿਆਦਾ ਨੇ ਸਕੂਲਾਂ ਦੀਆਂ ਹਮ ਹਾਂਜੀ ਹਾਂ ਡੀ ਏ ਵੀ ਸਕੂਲ ਠੀਕ ਹੈ ਸੀ ਬੀ ਐੱਸ ਈ ਦਾ ਸਕੂਲ ਵੀ ਹੈ ਤੁਸੀਂ ਦੇਖ ਲੈਣਾ ਜੇ ਤੁਹਾਨੂੰ ਕੋਈ ਹੋਰ ਮਦਦ ਦੀ ਲੋੜ ਹੋਵੇ ਮੈਨੂੰ ਤਾਂ ਦੱਸ ਦੇਣਾ ਠੀਕ ਹੈ ਠੀਕ ਹੈ ਜੀ